ਸਤਿ ਸ਼੍ਰੀ ਅਕਾਲ ਮੈਂ ਪਠਾਨਕੋਟ ਦੇ ਸ਼ਹਿਰ ਵਿੱਚ ਛੋਟੇ ਜਿਹੇ ਪਿੰਡ ਰਹਿਣ ਵਾਲਾ ਵਿਦਿਆਰਥੀ ਹੈਗਾ ਅਤੇ ਜਿਹੜੇ ਜਿਹੜਾ ਸਾਡਾ ਪਿੰਡ ਹੈਗਾ ਇਹ ਛੋਟਾ ਜਿਹਾ ਪਿੰਡ ਹੈਗਾ ਅਤੇ ਜੋ ਇਹਦੇ ਵਿੱਚ ਜਿਹੜੇ ਸਾਧਨ ਹੈਗੇ ਆ ਅਤੇ ਉਹਦੀ ਆਵਾਜਾਈ ਜਿਹੜੀ ਹੈਗੀ ਹੈ ਇਹ ਬਹੁਤ ਹੀ ਘੱਟ ਹੈਗੀ ਹੈ ਅਤੇ ਜੋ ਜਿਹਦੇ ਜੇ ਕਿਸੇ ਵਿਅਕਤੀ ਨੇ ਜਾਂ ਕਿਸੇ ਪਰਿਵਾਰ ਨੇ ਕਿਤੇ ਵੀ ਘੁੰਮਣ ਜਾਣਾ ਹੁੰਦਾ ਅਤੇ ਉਸ ਨੂੰ ਬੜੀ ਬੜੀ ਤੰਗੀ ਹੁੰਦੀ ਆ ਅਤੇ ਪਿੰਡ ਵਿੱਚ ਜਿਹੜੇ ਆਟੋ ਚਲਦੇ ਹੈਗੇ ਨੇ ਉਹ ਜਿਹੜੇ ਪੈਸੇ ਤੇਲ ਦਾ ਜਿਹੜਾ ਰੇਟ ਹੈਗਾ ਉਹ ਬੜਾ ਹੀ ਜ਼ਿਆਦਾ ਹੈਗਾ ਜਿਸ ਕਰਕੇ ਕਿ ਜਿਹੜੇ ਪਿੰਡ ਦੇ ਲੋਕ ਹੈਗੇ ਨੇ ਉਹ ਇੰਨੇ ਪੈਸੇ ਜਿਹੜੇ ਹੈਗੇ ਦੇ ਹੀ ਨਹੀਂ ਸਕਦੇ ਜਿਸ ਕਰਕੇ ਉਹਨਾਂ ਨੂੰ ਬੜਾ ਹੀ ਔਖਾ ਹੁੰਦਾ ਅਤੇ ਪੰਜ ਸੱਤ ਅੱਠ ਕਿਲੋਮੀਟਰ ਜਿਹੜਾ ਹੈਗਾ ਉਹ ਪਹਿਲੇ ਬੱਸ ਸਟੈਂਡ ਲਈ ਪੈਦਲ ਜਾਣਾ ਪੈਂਦਾ ਅਤੇ ਇਸ ਕਰਕੇ ਜਿਹੜੇ ਸਾਡੇ ਪਿੰਡ ਦੇ ਲੋਕ ਹੈਗੇ ਹੈ ਇਹ ਬੜੇ ਹੀ ਜ਼ਿਆਦਾ ਤੰਗ ਹੈਗੇ ਆ ਅਤੇ ਇਸ ਕਰਕੇ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੋ ਜਿਹੜੀਆਂ ਦੋ ਤਿੰਨ ਜਿਹੜੀਆਂ ਬੱਸਾਂ ਹੈਗੀਆਂ ਸਾਡੇ ਪਿੰਡ ਲਈ ਚਲਾਈਆਂ ਜਾਣ ਕਿ ਜੋ ਜਿਹੜੀ ਆਵਾਜਾਈ ਹੈ ਇਹ ਥੋੜ੍ਹੀ ਜਿਹੀ ਘੱਟ ਹੋ ਜੇ ਅਤੇ ਆਪ ਜੀ ਦਾ ਧੰਨਵਾਦ